ਮੈਨੂੰ ਗੀਤ ਸੁਣਨੇ ਬਹੁਤ ਵਧੀਆ ਲੱਗਦੇ ਨੇ ਕਦੇ ਕਦੇ ਮੈਂ ਥੋੜ੍ਹਾ ਥੋੜ੍ਹਾ ਗਾ ਵੀ ਲੈਂਦੀ ਹਾਂ ਅਤੇ ਅਸਲ ਦੇ ਵਿੱਚ ਜਦੋਂ ਮਨ ਬਹੁਤ ਜ਼ਿਆਦਾ ਨਿਰਾਸ਼ ਹੁੰਦਾ ਹੈ ਜਾਂ ਸਥਿਤੀ ਠੀਕ ਨਹੀਂ ਹੁੰਦੀ ਤਾਂ ਮੈਨੂੰ ਸਮੇਂ ਦੇ ਵਿੱਚ ਸਤਿੰਦਰ ਸਰਤਾਜ ਬਾਬਾ ਵੇਲੀ ਇਹਨਾਂ ਦੇ ਗੀਤ ਸੁਣਨੇ ਬਹੁਤ ਵਧੀਆ ਲੱਗਦੇ ਹਨ ਜਿਹੜੀ ਗਾਇਕੀ ਹੁੰਦੀ ਆ ਇਹ ਸਮਾਜ ਨੂੰ ਇੱਕ ਸੇਧ ਦੇਣ ਦੇ ਵਿੱਚ ਬਹੁਤ ਭੂਮਿਕਾ ਨਿਭਾਉਂਦੀ ਹੈ ਜਿਹੜੀ ਗਾਇਕ ਹੁੰਦੇ ਨੇ ਉਹਨਾਂ ਨੂੰ ਇਹੋ ਜਿਹੇ ਗੀਤ ਗਾਉਣੇ ਚਾਹੀਦੇ ਹਨ ਜਿਹੜੀ ਕਿ ਸਮਾਜ ਨੂੰ ਇੱਕ ਭਲਾਈ ਦੇ ਹਿੱਤ ਹੋਣ ਲੋਕਾਂ ਦੇ ਮਨ ਨੂੰ ਭਾਉਂਦੇ ਹਨ ਜਾਂ ਲੋਕਾਂ ਨੂੰ ਆ ਆਕਰਸ਼ਿਤ ਕਰਨ ਅਸਲ ਦੇ ਵਿੱਚ ਜਿਹੜੀ ਗਾਇਕ ਹੁੰਦੇ ਆ ਲੋਕਾਂ ਨੂੰ ਉਹ ਜਾਗਰੂਕ ਕਰਨ ਦੇ ਲਈ ਜਾਂ ਲੋਕਾਂ ਦੇ ਹੱਕਾਂ ਦੇ ਲੜਾਈ ਦੇ ਲਈ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦੇ ਲਈ ਉਹਨਾਂ ਨੂੰ ਅਜਿਹੇ ਗੀਤ ਗਾਉਣੇ ਚਾਹੀਦੇ ਹਨ ਅਤੇ ਇੱਕ ਗਾਇਕ ਜਾਂ ਕਲਾਕਾਰ ਹੀ ਉਹ ਅਜਿਹਾ ਕਰ ਸਕਦਾ ਹੈਗਾ ਜਿਹੜਾ ਸਮਾਜ ਨੂੰ ਬਦਲਣ ਦੇ ਲਈ ਜਾਂ ਉਹਨਾਂ ਨੂੰ ਕ ਪ੍ਰੇਰਿਤ ਕਰ ਸਕੇ ਇਸ ਕਰਕੇ ਜਿਹੜੇ ਗਾਇਕ ਆ ਉਹਨਾਂ ਨੂੰ ਆਪਣੇ ਸਾਰੇ ਗੀਤਾਂ ਦੇ ਵਿੱਚ ਅਜਿਹੇ ਵਾਕੰਸ਼ ਅਜਿਹੇ ਸ਼ਬਦ ਸ਼ਾਮਿਲ ਕਰਨੇ ਚਾਹੀਦੇ ਹਨ ਜਿਹੜੇ ਕਿ ਲੋਕਾਂ ਨੂੰ ਟੁੰਬ ਸਕਣ ਉਹਨਾਂ ਨੂੰ ਭਾਅ ਸਕਣ ਅਤੇ ਜਿਹੜੇ ਲੋਕ ਹੈ ਉਹ ਚੰਗੇ ਗੀਤ ਉਹ ਸੁਣ ਸਕਣ